ਕੈਮਰਾ ਅੱਜ ਦੇ ਯੁੱਗ ਵਿੱਚ ਬਹੁਤ ਜ਼ਰੂਰੀ ਹੈ ਜਿਵੇਂ ਕਿ ਆਪਣੇ ਲਈ ਜਦੋਂ ਆਪਾਂ ਕਿਤੇ ਜਾਣਾ ਜਾਂ ਕਿਤੇ ਆਉਣਾ ਕੈਮਰਾ ਨਾਲ ਹੋਵੇਗਾ ਤਾਂ ਆਪਾਂ ਹਰੇਕ ਚੀਜ਼ ਕੈਪਚਰ ਕਰ ਸਕਾਂਗੇ ਹਰੇਕ ਮੂਵਮੈਂਟ ਕੈਪਚਰ ਕਰ ਸਕਾਂਗੇ ਜੇ ਮੈਂ ਜਾਂਦਾ ਹਮੇਸ਼ਾ ਪਹਾੜੀ ਏਰੀਏ ਦੇ ਵਿੱਚ ਤਾਂ ਮੈਂ ਹ ਮੇਰੇ ਨਾਲ ਹਮੇਸ਼ਾ ਕੈਮਰਾ ਹੁੰਦਾ ਉੱਥੇ ਵਾਦੀਆਂ ਦੇ ਵਿੱਚ ਸੋਹਣੇ ਸੋਹਣੇ ਫੁੱਲ ਬੂਟੇ ਚੰਗੇ ਪਹਾੜ ਜੋ ਕਿ ਉਹਨਾਂ ਦੀਆਂ ਯਾਦਾਂ ਜਾਂ ਮੇਰੇ ਜ਼ਿੰਦਗੀ ਦੀਆਂ ਯਾਦਾਂ ਹਮੇਸ਼ਾ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਹਨ ਜਦੋਂ ਪੁਰਾਣੇ ਸਮੇਂ ਦੇ ਵਿੱਚ ਕੈਮਰਾ ਨਹੀਂ ਹੁੰਦਾ ਸੀ ਤਾਂ ਲੋਕ ਆਪਦੀਆਂ ਅੱਖਾਂ 'ਤੇ ਆਪਣੇ ਦਿਲ ਦੇ ਵਿੱਚ ਤਸਵੀਰਾਂ ਜਾਂ ਉੱਥੋਂ ਜਗ੍ਹਾ ਦੀ ਮੂਵਮੈਂਟ ਹਮੇਸ਼ਾ ਯਾਦ ਰੱਖਦੇ ਸੀ ਪ੍ਰੰਤੂ ਅੱਜ ਦੇ ਯੁੱਗ ਵਿੱਚ ਆਪਾਂ ਨੂੰ ਐਨਾ ਕੁ ਕੈਮਰੇ ਦਾ ਫਾਇਦਾ ਹੋ ਗਿਆ ਚਾਹੇ ਆਪਾਂ ਅੱਜ ਤੋਂ ਦਸ ਸਾਲ ਜਾਂ ਵੀਹ ਸਾਲ ਪੁਰਾਣੀਆਂ ਫੋਟੋਆਂ ਖਿੱਚੀਆਂ ਹੋਈਆਂ ਆਪਣੇ ਮੋਬਾਈਲ ਦੇ ਵਿੱਚ ਆਪਣੇ ਲੈਪਟੋਪ 'ਚ ਪਾ ਕੇ ਪੈਨ ਡਰਾਈਵ ਦੁਆਰਾ ਦੇਖ ਸਕਦੇ ਹਾਂ ਅਤੇ ਯਾਦਾਂ ਨੂੰ ਤਾਜ਼ਾ ਕਰ ਸਕਦੇ ਹਾਂ ਕੈਮਰੇ ਨਾਲ ਇੱਕ ਬਹੁਤ ਹੀ ਵੱਡੀ ਬੰਦੇ ਦੀ ਯਾਦਗਾਰ ਅਤੇ ਯਾਦ ਜੁੜੀ ਰਹਿੰਦੀ ਹੈ ਬਿਨਾ ਕੈਮਰੇ ਤੋਂ ਬੰਦਾ ਨਿਹੱਥਾ ਹੈ ਕੈਮਰਾ ਤੁਹਾਡੀ ਹਰੇਕ ਮੂਵਮੈਂਟ ਨੂੰ ਤੁਹਾਡੇ ਹਰ ਸਾਹ ਨੂੰ ਤੁਹਾਡੇ ਕਿਤੇ ਜਿੱਥੇ ਤੁਸੀਂ ਜਾਂਦੇ ਹੋ ਤੁਹਾਡੇ ਸੋਸ਼ਲ ਮੀਡੀਆ ਦੇ ਨਾਲ ਨਾਲ ਤੁਹਾਨੂੰ ਅਪਡੇਟ ਰੱਖਦਾ ਹੈ ਕੈਮਰਾ ਅੱਜ ਦੇ ਯੁੱਗ ਵਿੱਚ ਚਾਹੇ ਆਪਾਂ ਕਿਤੇ ਲਾਈਵ ਟੈਲੀਕਾਸਟ ਕਰਨਾ ਹੈ ਤਾਂ ਵੀ ਕੈਮਰੇ ਦੀ ਜ਼ਰੂਰੀ ਹੈ ਜੇ ਆਪਾਂ ਵੈਸੇ ਵੀ ਫੋਟੋਆਂ ਮੀਡੀਆ ਰਾਹੀਂ ਜਾਂ ਪ੍ਰਿੰਟ ਕਰਵਾਉਣੀਆਂ ਤਾਂ ਵੀ ਕੈਮਰਾ ਬਹੁਤ ਹੀ ਜ਼ਰੂਰੀ ਹੈ